ਹਾਂਜੀ ਤੁਸੀਂ ਇੰਝ ਕਰਿਓ ਕਿ ਕੱਲ ਸਵੇਰੇ ਦਸ ਕੁ ਵਜੇ ਦੇ ਟਾਈਮ ਦੇ ਨਾਲ ਨਾ ਇੱਕ ਹੋਸਪਿਟਲ ਆ ਅਤੇ ਉੱਥੇ ਤੁਸੀਂ ਮੈਨੂੰ ਮਿਲ ਜਾਇਓ ਮੇਰੀ ਸ਼ਿਫਟ ਹੈਗੀ ਜੋ ਦਸ ਵਜੇ ਤੋਂ ਲੈ ਕੇ ਇੱਕ ਵਜੇ ਤੱਕ ਉਹਦੇ ਵਿੱਚ ਵਿੱਚ ਤੁਸੀਂ ਕਿਹੜੇ ਵੀ ਟਾਈਮ ਜਿਹੜਾ ਤੁਸੀਂ ਮੈਨੂੰ ਮਿਲ ਸਕਦੇ ਹੋ ਅਤੇ ਹਾਂਜੀ ਹਾਂਜੀ ਅਗਰ ਤਾਂ ਤੁਹਾਨੂੰ ਫੀਵਰ ਆ ਹੈ ਨਾ ਬੁਖਾਰ ਹੈਗਾ ਆ ਤਾਂ ਤੁਸੀਂ ਇੰਝ ਕਰੋ ਪੈਰਾਸੀਟਾਮੋਲ ਦੀ ਫੋਰ ਫਿਫਟੀ ਐੱਮ ਜੀ ਦੀ ਹੁੰਦੀ ਆ ਟੈਬਲੇਟ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਅਤੇ ਅਗਰ ਜੇ ਤੁਹਾਨੂੰ ਉਹਦੇ ਨਾਲ ਫ਼ਰਕ ਨਹੀਂ ਲੱਗੇਗਾ ਨਾ ਤਾਂ ਫਿਰ ਥੋੜ੍ਹਾ ਕੁ ਟਾਈਮ ਰੁਕ ਕੇ ਕਦੀ ਰਾਤ ਨੂੰ ਮੈਡੀਸਨ ਲੈ ਲਓ ਪੈਰਾਸੀਟਾਮੋਲ ਅਗਰ ਤੁਹਾਨੂੰ ਨਹੀਂ ਫ਼ਰਕ ਲੱਗੇਗਾ ਫਿਰ ਤੁਸੀਂ ਡੋਲੋ ਜਿਹੜੀ ਆ ਨਾ ਉਹ ਸਿਕਸ ਫਿਫਟੀ ਦੀ ਹੁੰਦੀ ਆ ਮਤਲਬ ਕਿ ਹੁੰਦੀ ਸੇਮ ਹੀ ਆ ਬੁਖਾਰ ਵਾਸਤੇ ਹੁੰਦੀ ਆ ਪਰ ਇਹ ਹੈ ਕਿ ਜਿਹੜੀ ਇਹਦੇ ਡੋਜ ਜਿਹੜੀ ਆ ਨਾ ਥੋੜ੍ਹੀ ਜ਼ਿਆਦਾ ਹੁੰਦੀ ਆ ਸਿਕਸ ਫਿਫਟੀ ਡੋਲੋ ਵਾਲੀ ਤੁਸੀਂ ਉਹ ਲੈ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਹਾਨੂੰ ਕਫ ਵਗੈਰਾ ਹੈਗੀ ਖਾਂਸੀ ਆ ਤਾਂ ਉਹ ਤੁਸੀਂ ਇੱਕ ਸਟੀਮ ਲੈ ਸਕਦੇ ਹੋ ਠੀਕ ਹੈ ਮਤਲਬ ਸਟੀਮਰ ਜੇ ਤੁਹਾਡੇ ਘਰ ਹੈਗਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੰਝ ਕਰੋ ਕਿ ਪਾਣੀ ਗਰਮ ਕਰਕੇ ਨਾ ਵਿੱਚ ਥੋੜ੍ਹੀ ਜਿਹੀ ਵਿਕਸ ਪਾ ਕੇ ਅਤੇ ਉਹਦੀ ਤੁਸੀਂ ਸਟੀਮ ਲੈ ਸਕਦੇ ਜੋ ਠੀਕ ਹੈ ਅਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਮਤਲਬ ਕੋਈ ਕਾਹੜਾ ਬਣਾ ਕੇ ਪੀ ਸਕਦੇ ਹੋ ਜਿਹੜਾ ਅਦਰਕ ਪਾਣੀ ਦੇ ਵਿੱਚ ਗਰਮ ਕਰਕੇ ਅਦਰਕ ਲੌਂਗ ਲਾਚੀ ਮਗਾਂ ਪਾ ਕੇ ਨਾ ਅਤੇ ਉਹਦੇ ਨਾਲ ਤੁਸੀਂ ਜਿਹੜਾ ਤੁਸੀਂ ਪੀ ਸਕਦੇ ਹੋ ਠੀਕ ਹੈ ਹਾਂਜੀ ਅਤੇ ਕੱਲ੍ਹ ਤੁਸੀਂ ਇੰਝ ਕਰਿਓ ਦਸ ਵਜੇ ਤੋਂ ਲੈ ਕੇ ਨਾ ਇੱਕ ਵਜੇ ਤੱਕ ਦੇ ਵਿੱਚ ਵਿੱਚ ਤੁਸੀਂ ਆ ਜਾਇਓ ਠੀਕ ਹੈ ਅਤੇ ਕੋਸ਼ਿਸ਼ ਕਰਿਓ ਕਿ ਮਤਲਬ ਪਹਿਲਾਂ ਤੁਸੀਂ ਆਉਣ ਤੋਂ ਪਹਿਲਾਂ ਨਾ ਇੱਕ ਵਾਰੀ ਮਤਲਬ ਕਾਲ ਕਰਕੇ ਪੁੱਛ ਲਿਓ ਕਿਉਂਕਿ ਕੱਲ ਮੇਰੀ ਕਿਤੇ ਹੋਰ ਵੀ ਸ਼ਿਫਟ ਹੈਗੀ ਆ ਠੀਕ ਹੈ ਇੱਕ ਵਾਰ ਤੁਸੀਂ ਕਨਫਰਮ ਕਰ ਲਿਓ ਫਿਰ ਉਹਦੇ ਅਕੋਰਡਿੰਗ ਮੈਂ ਆਪਣਾ ਪਲੈਨ ਤੁਹਾਨੂੰ ਦੱਸ ਦਾਂਗੀ ਤੁਸੀਂ ਮੈਨੂੰ ਕਿੱਥੇ ਮਿਲ ਸਕਦੇ ਹੋ ਠੀਕ ਹੈ ਹਾਂਜੀ ਠੀਕ ਹੈ ਓਕੇ ਥੈਂਕ ਯੂ